ਮੈਂ ਦਿਕਸ਼ਾ ਵਾਸੀ ਗੁਰਦਾਸਪੁਰ ਜਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਪਹਿਲਾਂ ਬਿਜਲੀ ਵਿਭਾਗ ਵਿੱਚ ਨੌਕਰੀ ਕਰਦੀ ਸੀ ਤੇ ਹੁਣ ਮੇਰੀ ਬਦਲੀ ਸਿੱਖਿਆ ਵਿਭਾਗ ਵਿੱਚ ਹੋ ਗਈ ਹੈ ਅਤੇ ਮੈਂ ਬਿਜਲੀ ਵਿਭਾਗ ਵਿੱਚ ਸਿਰਫ ਪੰਜ ਸਾਲ ਹੀ ਨੌਕਰੀ ਕੀਤੀ ਹੈ ਅਤੇ ਹੁਣ ਮੈਨੂੰ ਮੇਰੇ ਮਾਲਕਾ ਤੋਂ ਇਹ ਪਤਾ ਚੱਲਿਆ ਹੈ ਕਿ ਤੁਹਾਡੇ ਆਮਦਨ ਟੈਕਸ ਨੂੰ ਲੈ ਕੇ ਕੁਝ ਸਵਾਲ ਹਨ ਅਤੇ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੇ ਪਿਛਲੇ ਪੰਜ ਸਾਲ ਦੀ ਨੌਕਰੀ ਵਿੱਚ ਹਰ ਸਾਲ ਆਮਦਨ ਟੈਕਸ ਸਮੇਂ ਸਿਰ ਭਰਿਆ ਹੈ ਅਤੇ ਮੈਂ ਮਾਨਵ ਸੰਸਾਧਨ ਵਿਭਾਗ ਨੂੰ ਵੀ ਬੇਨਤੀ ਕਰਦੀ ਹਾਂ ਜੋ ਕੀ ਆਮਦਨ ਟੈਕਸ ਵਿਭਾਗ ਹੈ ਉਹ ਮੇਰੇ ਪਿਛਲੇ ਪੰਜ ਸਾਲ ਦੇ ਆਮਦਨ ਟੈਕਸ ਦੇ ਵੈਰੀਫਿਕੇਸ਼ਨ ਕਰਕੇ ਮੇਰੇ ਨਵੇਂ ਮਾਲਕਾਂ ਦੇ ਪਤੇ ਤੇ ਭੇਜ ਦਿੱਤੀ ਜਾਵੇ ਤਾਂ ਕੀ ਮੇਰੇ ਅਫਸਰ ਮੇਰੇ ਆਮਦਨ ਟੈਕਸ ਦੀ ਪੁਸ਼ਟੀ ਕਰ ਸਕਣ ਅਤੇ ਉਸਨੂੰ ਵੈਰੀਫਾਈ ਕਰ ਸਕਣ ਮੈਂ ਆਪਣੇ ਪਿਛਲੇ ਪੰਜ ਸਾਲ ਦਾ ਟੈਕਸ ਹਰ ਸਾਲ ਸਮੇਂ ਸਿਰ ਹੀ ਭਰਿਆ ਹੈ ਤੇ ਜਦੋਂ ਤੁਸੀਂ ਇਹ ਨਵੇਂ ਪਤੇ ਤੇ ਮੇਰੇ ਟੈਕਸ ਦੇ ਡੋਕੂਮੈਂਟਸ ਭੇਜ ਦਵੋ ਗੇ ਤਾਂ ਮੈਨੂੰ ਵੀ ਸੂਚਨਾ ਦਿੱਤੀ ਜਾਵੇ ਤਾਂ ਕਿ ਮੈਂ ਆਪਣੇ ਨਵੇਂ ਮਾਲਕ ਤੋਂ ਇਹ ਵੈਰੀਫਾਈ ਕਰ ਸਕਾ ਕਿ ਮੇਰਾ ਪਿਛਲਾ ਟੈਕਸ ਜਿਹੜਾ ਹੈ ਉਹਨਾਂ ਦੇ ਡੋਕੂਮੈਂਟਸ ਉਹਨਾਂ ਨੂੰ ਪ੍ਰਾਪਤ ਹੋਏ ਹਨ ਜਾਂ ਨਹੀਂ ਧੰਨਵਾਦ